ਹਾਂਜੀ ਵਧੀਆ ਤੁਸੀਂ ਸੁਣਾਓ ਯਾਰ ਮੈਨੂੰ ਨਾ ਇੱਕ ਹੈਲਪ ਚਾਹੀਦੀ ਸੀਗੀ ਤੁਹਾਡੀ ਮੈਂ ਨਾ ਆਹ ਸੋਚ ਰਿਹਾ ਸੀਗਾ ਕਿ ਮੈਂ ਨਾ ਆਪਣੇ ਵਾਸਤੇ ਸਾਈਕਲ ਲੈ ਲਵਾਂ ਕਿਉਂਕਿ ਯਾਰ ਮੈਨੂੰ ਨਾ ਔਖਾ ਬੜਾ ਹੁੰਦਾ ਹੈਗਾ ਇੱਕ ਤਾਂ ਮੈਂ ਜਾਣਾ ਜ਼ਿਆਦਾ ਦੂਰ ਨਹੀਂ ਹੁੰਦਾ ਇੱਥੇ ਨੇੜੇ ਹੀ ਜਾਣਾ ਹੁੰਦਾ ਹੈਗਾ ਹੈ ਅਤੇ ਬਾਈਕ 'ਤੇ ਐਵੇਂ ਹੀ ਇੰਨਾ ਜ਼ਿਆਦਾ ਪੈਟਰੋਲ ਲੱਗ ਜਾਂਦਾ ਉੱਤੋਂ ਮੈਂ ਸੋਚ ਰਿਹਾ ਸੀਗਾ ਕਿ ਮੈਂ ਜੇ ਸਾਈਕਲ ਲਵਾਂਗਾ ਤਾਂ ਫਿਰ ਮੇਰਾ ਜਿਹੜਾ ਉਹ ਐਕਸਰਸਾਈਜ਼ ਵੀ ਆਪਣੀ ਕਸਰਤ ਵੀ ਹੁੰਦੀ ਰਹੂਗੀ ਹਾਂ ਉਹ ਚੀਜ਼ ਹੈ ਨਾ ਅਤੇ ਮੈਂ ਸੋਚਦਾ ਸੀਗਾ ਮੈਂ ਤਾਂ ਇੱਥੇ ਨਵਾਂ ਮੈਨੂੰ ਤਾਂ ਕੁਛ ਪਤਾ ਹੀ ਨਹੀਂ ਹੈਗਾ ਅਤੇ ਅੱਛਾ ਅੱਛਾ ਹਾਂ ਮੈਨੂੰ ਨਹੀਂ ਪਤਾ ਸੀ ਨਾ ਮੈਂ ਤਾਂ ਪਹਿਲੀ ਵਾਰੀ ਮੈਂ ਤਾਂ ਸੁਣ ਕੇ ਬੜਾ ਹੈਰਾਨ ਹੋਇਆ ਹਾਂ ਮਤਲਬ ਇੱਥੋਂ ਹੀ ਇੱਥੋਂ ਹੀ ਜਾਂਦੀਆਂ ਫਿਰ ਸਾਰੀਆਂ ਸਾਈਕਲਾਂ ਬਣ ਕੇ ਮਤਲਬ ਬਾਹਰ ਫਿਰ ਅੱਛਾ ਅੱਛਾ ਅੱਛਾ ਹੂੰ ਹੂੰ ਅੱਛਾ ਅੱਛਾ ਹੂੰ ਹੂੰ ਹੂੰ ਹੂੰ ਅੱਛਾ ਅੱਛਾ ਚਲੋ ਵਧੀਆ ਅੱਛਾ ਅੱਛਾ ਅਤੇ ਮੈਂ ਉਹ ਹੀ ਸੋਚ ਰਿਹਾ ਸੀਗਾ ਮੈਂ ਕਿਹਾ ਆਪਣੇ ਗੁਆਂਢੀ ਨੂੰ ਫ਼ੋਨ ਕਰਦਾ ਉਹ ਜ਼ਿਆਦਾ ਵਧੀਆ ਦੱਸ ਸਕੇਗਾ ਅਤੇ ਉਹ ਵੀ ਹੈ ਨਾ ਆਪਾਂ ਨਾਲ ਜਾ ਕੇ ਫਿਰ ਪਸੰਦ ਕਰ ਲਵਾਂਗੇ ਕਿਉਂਕਿ ਕੋਈ ਨਾਲ ਹੁੰਦਾ ਫਿਰ ਪਸੰਦ ਵਧੀਆ ਹੋ ਜਾਂਦੀ ਹੈ ਅਤੇ ਤੁਸੀਂ ਵੀ ਕੋਈ ਸੈਕਲ ਸੂਕਲ ਲਿੱਤੀ ਹੈ ਇੱਥੋਂ ਲੁਧਿਆਣਿਓ ਕੋਈ ਅੱਛਾ ਇੱਥੇ ਕਿੰਨੇ ਕੁ ਦੀ ਹੈ ਕਿੰਨੇ ਕੁ ਦੀ ਲਿੱਤੀ ਸੀ ਤੁਸੀਂ ਅੱਛਾ ਠੀਕ ਹੈ ਮੈਂ ਤਾਂ ਬੜਾ ਜ਼ਿਆਦਾ ਸੋਚ ਕੇ ਬੈਠਾ ਸੀ ਮੈਂ ਤਾਂ ਵੀਹ ਪੱਚੀ ਹਜ਼ਾਰ ਰੁਪਏ ਇੱਕ ਸੈਕਲ ਦਾ ਸੋਚ ਕੇ ਬੈਠਾ ਸੀ ਜੇ ਜ਼ਿਆਦਾ ਸਸਤੀ ਹੈ ਅੱਛਾ ਅੱਛਾ ਅੱਛਾ ਅੱਛਾ ਨਹੀਂ ਨਹੀਂ ਮੈਂ ਇੰਨੀ ਨਹੀਂ ਤਾਂ ਨਹੀਂ ਲੈਣੀ ਮੈਂ ਤਾਂ ਬੇਸਿਕ ਜਿਹੀ ਲੈਣੀ ਹੈ ਹੂੰ ਹੂੰ ਅੱਛਾ ਅੱਛਾ ਫਿਰ ਅੱਛਾ ਉਹ ਚੀਜ਼ ਹੈ ਚਲੋ ਮੈਂ ਦੇਖਦਾ ਜੇ ਇੱਦਾਂ ਕਰ ਲਵਾਂਗੇ ਨਾ ਜੇ ਸਹੀ ਪ੍ਰਾਈਸ 'ਚ ਮਿਲਦੀ ਹੋਵੇਗੀ ਤਾਂ ਮੈਂ ਆਪਣੀ ਇੱਕ ਵਹੁਟੀ ਵਾਸਤੇ ਵੀ ਲੈ ਲਵਾਂਗਾ ਨਾ ਅਤੇ ਆਪਾਂ ਆਪਾਂ ਇੱਦਾਂ ਕਰ ਸਕਦੇ ਹਾਂ ਮੈਂ ਪਹਿਲੇ ਪੁੱਛਣਾ ਸੀ ਜਾਂ ਇੱਥੋਂ ਕਿੰਨੀ ਕੁ ਦੂਰ ਹੈ ਜਿੱਥੇ ਆਪਾਂ ਲੈਣ ਜਾਣਾ ਹੈਗਾ ਕਿ ਮੈਂ ਸੋਚਦਾ ਸੀ ਅੱਛਾ ਮੈਂ ਨਹੀਂ ਉਹ ਸਾਈਡ ਸੁਇਡ ਤੋਂ ਨਹੀਂ ਮੈਨੂੰ ਐਂਅ ਜਿੱਥੇ ਜਾਈਏ ਮਤਲਬ ਸਸਤੀ ਅਤੇ ਵਧੀਆ ਮਿਲ ਜਾਵੇ ਆਪਾਂ ਉੱਥੇ ਚਲਦੇ ਹਾਂ ਨਾ ਹੂੰ ਅੱਛਾ ਅੱਛਾ ਚਲੋ ਪਹਿਲੇ ਹੀਰੋ ਅਤੇ ਓਧਰ ਐੱਸ ਕੇ ਵਾਲੇ ਦੇ ਕੋਲ ਚੱਲ ਜਾਵਾਂਗੇ ਜਗਦੰਬੇ ਵਾਲੇ ਦੇ ਹੋ ਆਵਾਂਗੇ ਜਿਹਦਾ ਰੇਟ ਵਧੀਆ ਹੋਵੇਗਾ ਫਿਰ ਆਪਾਂ ਦੂਰ ਹਾਂ ਮੈਂ ਉਹ ਹੀ ਸ ਉਹ ਹੀ ਦੇਖ ਰਿਹਾ ਸੀ ਮੈਂ ਇੱਕ ਵ ਲਾਈਟ ਵੇਟ ਉਹ ਕਾਰਬਨ ਫਾਈਬਰ ਵਾਲੀ ਡਿਸਕ ਬਰੇਕਾਂ ਵਾਲੀ ਦੇਖ ਰਿਹਾ ਸੀ ਜਿਹੜੀ ਦੋ ਹੀ ਲੈ ਲਾਵਾਂਗੇ ਅਤੇ ਜੇ ਸਹੀ ਪ੍ਰਾਈਸ 'ਚ ਆਈ ਨਹੀਂ ਤਾਂ ਫਿਰ ਇੱਕ ਹੀ ਲੈ ਆਵਾਂਗੇ ਮੈਂ ਫਿਰ ਇੱਦਾਂ ਕਰਦੇ ਨਾ ਤੁਸੀਂ ਸਵੇਰੇ ਅਵੇਲੇਬਲ ਹੈਗੇ ਹੋ ਕੱਲ੍ਹ ਸੰਡੇ ਹੀ ਹੈਗਾ ਨਾ ਆਪਾਂ ਜਾ ਸਕਦੇ ਹਾਂ ਕੱਲ੍ਹ ਆਪਾਂ ਇੱਦਾਂ ਕਰਦੇ ਹੈ ਕੱਲ੍ਹ ਕਿੰਨੇ ਕੁ ਵਜੇ ਚੱਲੀਏ ਫਿਰ ਚੱਲੋ ਠੀਕ ਹੈ ਮੈਂ ਤੁਹਾਨੂੰ ਕੱਲ੍ਹ ਸਵੇਰੇ ਫਿਰ ਫ਼ੋਨ ਕਰਦਾ ਹਾਂ ਫਿਰ ਆਪਾਂ ਚੱਲਦੇ ਹਾਂ ਕੱਲ੍ਹ ਫਿਰ ਠੀਕ ਹੈ ਓਕੇ